ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਉੱਨੀ ਸੌ ਸੰਤਾਲੀ ਵਿੱਚ ਮਿਲੀ ਜੋ ਕਿ ਸਾ ਮਹਾਨ ਜੋ ਕਿ ਸਾਡੇ ਮਹਾਨ ਯੋਧਿਆਂ ਅਤੇ ਮਹਾਨ ਨੇਤਾਵਾਂ ਦੀ ਦੇਣ ਹੈ ਇਹ ਜੋ ਕਿ ਨਰਮ ਦਲ ਅਤੇ ਗਰਮਦਲ ਨਾਲ ਸੰਬੰਧਿਤ ਸਨ ਨਰਮ ਦਲ ਦੇ ਨੇਤਾ ਵਿੱਚ ਮਹਾਤਮਾ ਗਾਂਧੀ ਜੀ ਜਵਾਹਰ ਲਾਲ ਨਹਿਰੂ ਜੀ ਅਤੇ ਹੋਰ ਰਾਜਨੀਤਿਕ ਨੇਤਾ ਸ਼ਾਮਿਲ ਸਨ ਅਤੇ ਇਸ ਦੇ ਨਾਲ ਹੀ ਗਰਮ ਦਲ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਊਧਮ ਸਿੰਘ ਜੀ ਅਤੇ ਲਾਲਾ ਲਾਜਪਤ ਰਾਏ ਜੀ ਅਤੇ ਸ਼ਾਮਿਲ ਹਨ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕੀਤੇ ਜਿਹਨਾਂ ਨੇ ਭਾਰਤ ਨੂੰ ਜਾਗਰਿਤ ਕੀਤਾ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਲੈਣੀ ਜ਼ਰੂਰੀ ਹੈ ਮਹਾਤਮਾ ਗਾਂਧੀ ਜੀ ਜੋ ਕਿ ਸ ਜਿਹਨਾਂ ਨੂੰ ਰਾਸ਼ਟਰ ਪਿਤਾ ਦਾ ਨਾਮ ਦਿੱਤਾ ਜਾਂਦਾ ਹੈ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕੀਤੇ ਉਹਨਾਂ ਨੇ ਉਹਨਾਂ ਵਿਰੁੱਧ ਅੰਦੋਲਨ ਵੀ ਚਲਾਏ ਜਿਸ ਵਿੱਚ ਇਹ ਸਹਿਯੋਗ ਅੰਦੋਲਨ ਸ਼ਵਦੇਸੀ ਅੰਦੋਲਨ ਅਤੇ ਲੂਣ ਸੱਤਿਆ ਗ੍ਰਹਿ ਅੰਦੋਲਨ ਸ਼ਾਮਿਲ ਸੀ ਅਸਹਿਯੋਗ ਅੰਦੋਲਨ ਤੋਂ ਭਾਵ ਹੈ ਕਿ ਜ ਜਿਹੜੀਆਂ ਵੀ ਵਸਤੂਆਂ ਜਾਂ ਚੀਜ਼ਾਂ ਅਸੀਂ ਵਿਦੇਸ਼ਾਂ ਤੋਂ ਮੰਗਾਉਂਦੇ ਹਨ ਉਹਨਾਂ ਨਾਲ ਅਸਹਿਯੋਗ ਕਰਨਾ ਭਾਵ ਕਿ ਉਹਨਾਂ ਉਹਨਾਂ ਦੀ ਵਰਤੋਂ ਨਾ ਕਰਕੇ ਸਵਦੇਸ਼ੀ ਵਰਤਾ ਦੀ ਵਰਤੋਂ ਕਰਨੀ ਉਹਨਾਂ ਵਿਦੇਸ਼ੀ ਕੰਪ ਵਿਦੇਸ਼ੀ ਕਿਸੇ ਵੀ ਕੰਪਨੀ ਵਿੱਚ ਕੰਮ ਨਾ ਕਰਨਾ ਨਾ ਹੀ ਉਹਨਾਂ ਦੀ ਕੋਈ ਵੀ ਸਹਾਇਤਾ ਕਰਨੀ ਅਤੇ ਨਾ ਹੀ ਵਿਦੇਸੀ ਵਸਤੂਆਂ ਦੀ ਵਰਤੋਂ ਕਰਨਾ ਉਹਨਾਂ ਨੇ ਸਵਦੇਸ਼ੀ ਅੰਦੋਲਨ ਨੂੰ ਪਹਿਲ ਦਿੱਤੀ ਸਵਦੇਸ਼ੀ ਦਾ ਭਾਵ ਕਿ ਆਪਣੇ ਦੇਸ਼ ਦੇ ਹੀ ਹ ਹਰੇਕ ਚੀਜ਼ ਦੀ ਵਰਤੋਂ ਕਰਨਾ ਆਪਣੇ ਦੇਸ਼ ਨਾਲ ਹੀ ਸਹਿਯੋਗ ਕਰਨਾ ਉਹਨਾਂ ਨੇ ਅੰਗਰੇਜ਼ਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਉਹਨਾਂ ਨੇ ਲੂਣ ਸੱਤਿਆਗ੍ਰਹਿ ਵੀ ਸ ਲੂਣ ਸੱਤਿਆਗ੍ਰਹਿ ਵੀ ਅਪਣਾਇਆ ਜਿਸ ਜਿਸਦਾ ਭਾਵ ਸੀ ਕਿ ਆਪਾਂ ਮਤਲਬ ਅੰਗਰੇਜ਼ਾਂ ਦੀ ਕਿਸੇ ਵੀ ਚੀਜ਼ ਦੀ ਵਰਤੋਂ ਨਾ ਕਰਨੀ ਆਪਣਾ ਹੀ ਲੂਣ ਬਣਾ ਕੇ ਆਪਣਾ ਹੀ ਅਪ ਆਪ ਹੀ ਖਾਣਾ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਅੰਦੋਲਨ ਸ਼ੁਰੂ ਕੀਤੇ ਜਿਸ ਤੋਂ ਭਾ ਜੋ ਕਿ ਸਾਨੂੰ ਆਜ਼ਾਦੀ ਦਵਾਉਣ ਲਈ ਬਹੁਤ ਕਾਰਗਰ ਸਾਬਿਤ ਹੋਏ ਅੰਗਰੇਜ਼ਾਂ ਤੋਂ ਆਜ਼ਾਦੀ ਦਵਾਉਣ ਲਈ ਸਭ ਤੋਂ ਸਭ ਤੋਂ ਵੱਡੀ ਜ਼ਿੰਮੇਵਾਰੀ ਲਿਤੀ ਸੀ ਸਾਹਿਬ ਸ਼ਹੀਦ ਭਗਤ ਸਿੰਘ ਜੀ ਨੇ ਜਿਹਨਾਂ ਨੇ ਕਿ ਬਹੁਤ ਹੀ ਛੋਟੀ ਉਮਰ ਵਿੱਚ ਤੇਈ ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਭ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮਿਆ ਜਿਸ ਦੀ ਬਦੌਲਤ ਭਾਰਤ ਦੇਸ਼ ਆਜ਼ਾਦ ਹੋਇਆ